ਮੈਨੂੰ ਬਾਗਵਾਨੀ ਕਰਨ ਦਾ ਕਾਫੀ ਸ਼ੌਂਕ ਹੈ ਬਾਗਾਬਾਨੀ ਕਰਦੇ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਜਮੀਨ ਨੂੰ ਬਾਗਵਾਨੀ ਦੇ ਯੋਗ ਬਣਾਉਣਾ ਉਸ ਦੇ ਵਿੱਚ ਵਿੱਚੋਂ ਕੰਕਰ ਪੱਥਰ ਕੱਢਣੇ ਅਤੇ ਘਾਹ ਫੂਸ ਸਾਫ ਕਰਨਾ ਅਤੇ ਉਸ ਤੋਂ ਬਾਅਦ ਬੀਜ ਬਿਜਾਈ ਦਾ ਕੰਮ ਕਰਨਾ ਅਤੇ ਫਿਰ ਜਦੋਂ ਪਨੀਰੀ ਜਾਂ ਬੂਟੇ ਵੱਡੇ ਹੋ ਜਾਂਦੇ ਨੇ ਉਹਨਾਂ 'ਤੇ ਜੇ ਕੋਈ ਬਿਮਾਰੀ ਪੈ ਜੇ ਕੀੜਿਆਂ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਹਦੇ ਉੱਪਰ ਜਿਵੇਂ ਦੇਸੀ ਜੋ ਤਰੀਕਾ ਹੈ ਸਵਾਹ ਦਾ ਸਵਾਹ ਛਿੜਕ ਕੇ ਪੱਤਿਆਂ ਦੇ ਉੱਪਰ ਜਾਂ ਕੁਛ ਔਰਗੈਨਿਕ ਹੋਰ ਜਿਹੜੇ ਤਰੀਕੇ ਨੇ ਅਪਣਾ ਕੇ ਉਹ ਵੀ ਜੇ ਉਸ ਤੋਂ ਵੀ ਜੇ ਨਾ ਠੀਕ ਹੋਵੇ ਫਿਰ ਆਪਣਾ ਜਿਹੜੇ ਕੈਮੀਕਲ ਪੈਸਟੀਸਾਈਡ ਲੱਤ ਕੇ ਘੱਟ ਮਾਤਰਾ ਵਿੱਚ ਉਹਨਾਂ ਨੂੰ ਅਸੀਂ ਦੂਰ ਕਰਨ ਦਾ ਕਰ ਸਕਦੇ ਹਾਂ